ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਤੁਹਾਡਾ ਇਤਿਹਾਸ ਅਧਿਆਪਕ ਬੋਲਦਿਆਂ ਤੁਸੀਂ ਕਿਸ ਵਿਸ਼ੇ ਬਾਰੇ ਗੱਲ ਕਰਨੀ ਹੈ ਵਧੀਆ ਵਧੀਆ ਜੀ ਮੈਂ ਥੋਨੂੰ ਦੱਸ ਸਕਦਾ ਇਹ ਬਹੁਤ ਹੀ ਇੱਕ ਮਹੱਤਵਪੂਰਨ ਵਿਸ਼ਾ ਹੈ ਕਪੂਰਥਲਾ ਨੂੰ ਪੰਜਾਬ ਦਾ ਪੈਰੀਜ ਵੀ ਕਿਹਾ ਜਾਂਦਾ ਕਿਉਂਕਿ ਇਸ ਦੀ ਜਿਹੜੀ ਵਸ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਜੀ ਰਾਜਧਾਨੀ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਕਪੂਰਥਲਾ ਵਿੱਚ ਕਈ ਇਤਿਹਾਸ ਦੀ ਗੁਰਦੁਆਰੇ ਹਨ ਪਰ ਕੁਝ ਬਹੁਤ ਹੀ ਜਿਆਦਾ ਮਹੱਤਵਪੂਰਨ ਹਨ ਜਿਨਾਂ ਬਾਰੇ ਮੈਂ ਤੁਹਾਨੂੰ ਅੱਜ ਦੱਸਾਂਗਾ ਜਿਵੇਂ ਕਿ ਪਹਿਲਾਂ ਗੁਰਦੁਆਰਾ ਗੁਰਦੁਆਰਾ ਬੇਰੀ ਸਾਹਿਬ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀਗਾ ਮੰਨਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਉਹਨਾਂ ਨੇ ਇੱਕ ਬੇੜੀ ਦਾ ਰੁੱਖ ਲਾਇਆ ਸੀ ਜੋ ਅੱਜ ਵੀ ਉੱਥੇ ਮੌਜੂਦ ਹੈ ਅਗਰ ਆਪਾਂ ਦੂਸਰੇ ਗੁਰਦੁਆਰਾ ਜੀ ਬਾਰੇ ਗੱਲ ਕਰੀਏ ਤਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਕਿ ਕਪੂਥਲਾ ਵਿੱਚ ਹੀ ਸਥਿਤ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਬਖਸ਼ਿਸ਼ ਨਾਲ ਇਲਾਕੇ ਦੇ ਲੋਕਾਂ ਦੇ ਦੁੱਖ ਦੂਰ ਹੋਏ ਸਨ ਤੇ ਤੀਸਰੇ ਗੁਰਦੁਆਰੇ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਗੁਰਦੁਆਰਾ ਚੋਲਾ ਸਾਹਿਬ ਜੀ ਜੋ ਕੀ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਨੇੜੇ ਹੀ ਹੈ ਜਿੱਥੇ ਕਿ ਮੰਨਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣਾ ਚੋਲਾ ਜਿਹਨੂੰ ਆਪਾਂ ਕੱਪੜਾ ਵੀ ਕਹਿੰਦੇ ਹਾਂ ਉਹ ਉਥੇ ਛੱਡਿਆ ਸੀਗਾ ਤੇ ਉਸ ਦੀ ਯਾਦ ਵਿੱਚ ਉਥੇ ਗੁਰਦੁਆਰਾ ਚੋਲਾਂ ਸਾਹਿਬ ਬਣਾਇਆ ਗਿਆ ਸੀਗਾ ਹਾਂਜੀ ਹਾਂਜੀ ਜਿਨਾਂ ਜਿਨਾਂ ਨੂੰ ਪਤਾ ਕਿ ਕਪੂਰਥਲੇ ਛੋਟਾ ਜਿਹਾ ਸ਼ਹਿਰ ਹੈ ਤੇ ਤੁਹਾਨੂੰ ਅਗਰ ਤੁਸੀਂ ਕਿਤੇ ਵੀ ਜਾਣਾ ਹੋਏਗਾ ਤਾ ਤੁਹਾਨੂੰ ਅੱਧੇ ਘੰਟਾ ਜਾਂ ਘੰਟੇ ਦਾ ਸਮਾਂ ਹੀ ਲੱਗੇਗਾ ਅਸੀਂ ਇੱਥੇ ਜਿਵੇਂ ਕਿ ਪਬਲਿਕ ਟਰਾਂਸਪੋਰਟ ਵੀ ਉਪਲਬਧ ਹਨ ਜਾਂ ਤੁਸੀਂ ਕੋਈ ਵੀ ਪਬਲਿਕ ਟਰਾਂਸਪੋਰਟ ਕਰਕੇ ਕਿਉਂਕਿ ਜਾ ਸਕਦੇ ਹੋ ਜਿਵੇਂ ਕੀ ਗੁਰਦੁਆਰਾ ਬੇਰੀ ਸਾਹਿਬ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸ਼ਹਿਰ ਦੇ ਅੰਦਰ ਹੀ ਹਨ ਜਿਹੜਾ ਜਦ ਕਿ ਗੁਰਦੁਆਰਾ ਚੋਲਾ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਹਾਂਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਸਿੱਖ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਵੀ ਗੁਰੂ ਸਾਹਿਬਾਨ ਦਾ ਜਨਮ ਹੁੰਦਾ ਆ ਤਾਂ ਉਹਨਾਂ ਦੀ ਯਾਦ ਵਿੱਚ ਅਸੀਂ ਪੂਰੇ ਨਗਰ ਵਿੱਚ ਕੀਰਤਨ ਕਰਦੇ ਆਂ ਤੇ ਹੁਣ ਜਿਸ ਨੂੰ ਨਗਰ ਕੀਰਤਨ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਜਨਮ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਲਗਾਇਆ ਜਾਂਦਾ ਤੇ ਭਗਤੀ ਕੀਰਤਨ ਵੀ ਹੁੰਦੇ ਸਤਿ ਸ੍ਰੀ ਅਕਾਲ ਜੀ